ਮੈਂ ਪੰਛੀਆਂ ਦੀ ਨਾ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਬਰਤਨ ਰੱਖਿਆ ਹੈ ਜਿਹਦੇ 'ਚ ਮੈਂ ਡੇਲੀ ਪਾਣੀ ਵੀ ਰੱਖਦੀ ਹਾਂ ਅਤੇ ਦੂਸਰੇ ਬਰਤਨ ਵਿੱਚ ਸਤਨਾਜਾ ਜੋ ਚ ਅਨਾਜ ਰੱਖਦੀ ਹਾਂ ਜਿਹਦੇ ਨਾਲ਼ ਪੰਛੀ ਆ ਕੇ ਉਹਨਾਂ ਨੂੰ ਖਾ ਲੈਣ ਅਤੇ ਪੰਛੀਆਂ ਦਾ ਜ਼ਰੂਰ ਸਾਨੂੰ ਖਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਮੈਂ ਕੁਛ ਨਾ ਕੁਛ ਇੱਦਾਂ ਦੇ ਟਿਪਸ ਕੁਛ ਸੁਜੈਸ਼ਨ ਦੇਖਦੀ ਰਹਿਣੀ ਨੈੱਟ ਅਤੇ ਕਿ ਜਿਹਦੇ ਨਾਲ਼ ਜਿਹੜੇ ਪੰਛੀ ਏ ਉਹ ਜ਼ਿਆਦਾ ਤੋਂ ਜ਼ਿਆਦਾ ਆਉਣ ਚਹਿਚਹਾਉਣ 'ਤੇ ਸਭ ਤੋਂ ਜਅ ਜ਼ਿਆਦਾ ਜ਼ਰੂਰੀ ਕਿ ਇਹਨਾਂ ਦਾ ਬਚਾਅ ਹੋ ਸਕੇ ਕਿਉਂਕਿ ਜਿਹੜਾ ਸਾਡਾ ਆ ਇੱਕ ਵਾਤਾਵਰਨ ਹੈ ਉਹ ਸਿਰਫ਼ ਅਤੇ ਸਿਰਫ਼ ਬਚਿਆ ਹੈ ਇਹਨਾਂ ਪੰਛੀਆਂ ਦੇ ਕਾਰਨ ਕੁਦਰਤ ਦੀ ਜਿਹੜਾ ਬਚਾਅ ਹੈ ਨਾ ਉਹ ਬਹੁਤ ਜ਼ਰੂਰੀ ਹੈ ਕਿ ਉਹ ਜਿਹੜੀ ਕੁਦਰਤ ਦੀ ਮਾਰ ਹੈ ਨਾ ਉਹ ਫਿਰ ਉਹਦਾ ਫਿਰ ਦ ਜਦੋਂ ਮਾਰ ਪੈਂਦੀ ਤਾਂ ਉਹਦੇ ਨਾਲ਼ ਇਨਸਾਨ ਜੋ ਜਲਦੀ ਤਾਪੇ ਨਹੀਂ ਆਉਂਦਾ ਸੋ ਬਹੁਤ ਜ਼ਰੂਰੀ ਹੈ ਕੁਦਰਤ ਨੂੰ ਬਚਾਅ ਕੇ ਰੱਖਣਾ ਇਹਨਾਂ ਪੰਛੀਆਂ ਬਚਾਅ ਕੇ ਰੱਖਣਾ ਇਹਨਾਂ ਪੰਛੀਆਂ ਦਾ ਧਿਆਨ ਰੱਖਣਾ ਅਤੇ ਜਿਹਦੇ ਲਈ ਸਾਨੂੰ ਚਾਹੀਦਾ ਕਿ ਇਹਨਾਂ ਲਈ ਅਸੀਂ ਕਟੋਰਿਆਂ ਵਿੱਚ ਪਾਣੀ ਪਾ ਕੇ ਰੱਖੀਏ ਇਹਨਾਂ ਲਈ ਕੁਛ ਅਨਾਜ ਪਾ ਕੇ ਰੱਖੀਏ ਇਹਨਾਂ ਨੂੰ ਅਸੀਂ ਘਰ ਵੀ ਪਾਲੀਏ ਜਿਸ ਤਰ੍ਹਾਂ ਕਈ ਪੰਛੀਆਂ ਨੂੰ ਅਸੀਂ ਘਰ ਵੀ ਪਾਲ ਸਕਦੇ ਉਹਨਾਂ ਲਈ ਪਿੰਜਰੇ ਲੈ ਕੇ ਆਈਏ ਅਤੇ ਜਿਹਦੇ ਨਾਲ਼ ਸਾਡਾ ਜਿਹੜਾ ਵਾਤਾਵਰਨ ਹੈ ਉਹ ਹੋਰ ਸੁੰਦਰ ਬਣੇ